ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ 'ਤੇ ਜਾਂਦੇ ਹਾਂ ਉਸ ਦੇ ਸਾਹਮਣੇ ਕਈ ਦੁਕਾਨਾਂ ਬਣੀਆਂ ਹੁੰਦੀਆਂ ਹਨ ਜਿਸ ਵਿੱਚ ਸਾਡੇ ਧਰਮ ਦਾ ਸਮਾਨ ਹੁੰਦਾ ਹੈ ਜਿਵੇਂ ਕੰਘਾ ਕੜੇ ਕਿਰਪਾਨ ਬੰਦੂਕਾਂ ਆਦਿ ਮਿਲਦੇ ਹਨ ਜਿਸ ਨਾਲ਼ ਸਾਡਾ ਕਾਰੋਬਾਰ ਵੀ ਚੱਲਦਾ ਹੈ ਜਿਸ ਨਾਲ਼ ਸਾਨੂੰ ਪੈਸੇ ਮਿਲਦੇ ਹਨ ਪੈਸਿਆਂ ਨਾਲ਼ ਮੁਨਾਫਾ ਹੋ ਜਾਂਦਾ ਹੈ ਅਤੇ ਉਸ ਨਾਲ਼ ਸਾਡੇ ਧਰਮ ਦਾ ਪ੍ਰਚਾਰ ਵੀ ਹੁੰਦਾ ਹੈ ਇਸ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਦੇ ਖੇਤਰ ਵਿੱਚ ਇਹ ਕੰਮ ਕਰਨੇ ਚਾਹੀਦੇ ਹਨ